ਪੰਜਾਬ ਰਾਜ ਵਿੱਚ ਬਹੁਤ ਹੀ ਧਾਰਮਿਕ ਸਥਾਨ ਹਨ ਹਿੰਦੂਆਂ ਦੇ ਆਪਣੇ ਹਨ ਸਿੱਖਾਂ ਦੇ ਆਪਣੇ ਹਨ ਮੁਸਲਮਾਨਾਂ ਦੇ ਆਪਣੇ ਹਨ ਅਤੇ ਹੋਰ ਧਰਮਾਂ ਦੇ ਆਪਣੇ ਆਪਣੇ ਨੇ ਅਤੇ ਅਤੇ ਮੈਂ ਪਟਿਆਲੇ ਵੇ ਸ਼ਹਿਰ ਵਿੱਚ ਰਹਿੰਦਾ ਹਾਂ ਅਤੇ ਪਟਿਆਲੇ ਸ਼ਹਿਰ ਦੇ ਵਿੱਚ ਆਪਣਾ ਦੁਖਨਿਵਾਰਨ ਗੁਰਦੁਆਰਾ ਸਾਹਿਬ ਅਤੇ ਕਾਲੀ ਦੇਵੀ ਦਾ ਮੰਦਰ ਅਤੇ ਹੋਰ ਵੀ ਧਾਰਮਿਕ ਸਥਾਨ ਬਹੁਤ ਨੇ ਅਤੇ ਦੁਖਨਿਵਾਰਨ ਗੁਰਦੁਆਰਾ ਸਾਹਿਬ ਤਕਰੀਬਨ ਮੈਂ ਦੋ ਤਿੰਨ ਦਿਨਾਂ ਬਾਅਦ ਜਾਂਦੇ ਹੀ ਰਹਿੰਦਾ ਅਤੇ ਮੱਥਾ ਟੇਕਦੇ ਹਾਂ ਉੱਥੇ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਪਰਮਾਤਮਾ ਤੂੰ ਸਾਨੂੰ ਪੈਦਾ ਕੀਤਾ ਹੈ ਤੂੰ ਸਾਨੂੰ ਸਾਰਾ ਕੁਛ ਅਨਾਜ ਦੇ ਰਿਹਾਂ ਸਾਡੀ ਪਰਵਰਿਸ਼ ਕਰ ਰਿਹਾਂ ਅਤੇ ਮੇਰਾ ਤਕਰੀਬਨ ਹਫ਼ਤੇ ਦੇ ਵਿੱਚ ਦੋ ਵਾਰੀ ਜਾਂ ਤਿੰਨ ਵਾਰੀ ਜਦੋਂ ਵੀ ਮੇਰਾ ਸਮਾਂ ਲੱਗਦਾ ਹੈ ਕੋਸ਼ਿਸ਼ ਕਰਦਾ ਮੈਂ ਉੱਥੇ ਜਾਂਦਾ ਹਾਂ ਘੰਟੇ ਦੋ ਲਾ ਕੇ ਆਉਂਦਾ ਪਰਮਾਤਮਾ ਦੀ ਇਬਾਦਤ ਕਰਦਾ ਹਾਂ ਅਤੇ ਸਿਮਰਨ ਭ ਭਜਨ ਵੀ ਕਰਦੇ ਹਾਂ ਅਤੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰਾਂ ਦੀ ਸੇਵਾ ਕਰਦੇ ਹਾਂ ਜਿੰਨਾ ਕੁ ਹੋ ਸਕਦਾ ਹੈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਨਾਲ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਹਾਂ ਆਪਾਂ ਜਦੋਂ ਧਾਰਮਿਕ ਦੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ ਆਪਣਾ ਸਾਰਾ ਸਟਰੈਸ ਕਿਸੇ ਵੀ ਤਰ੍ਹਾਂ ਦਾ ਸਭ ਨਿਕਲ ਜਾਂਦਾ ਅਤੇ ਉੱਥੇ ਜਾ ਕੇ ਮਨ ਬਹੁਤ ਹੀ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਆਪਾਂ ਕਿਹੜੇ ਝੰਜਟਾਂ ਚੋਂ ਨਿਕਲ ਕੇ ਪਰਮਾਤਮਾ ਦੇ ਨਾਮ ਵੱਲ ਲੱਗੇ ਹੋਏ ਹਾਂ ਜਿਨਾਂ ਨੇ ਸਾਨੂੰ ਪੈਦਾ ਕੀਤਾ ਹੈ ਦੁਖਨਿਵਰਾਨ ਸਾਹਿਬ ਗੁਰਦੁਆਰਾ ਜੋ ਕਿ ਇੱਥੋਂ ਤਕਰੀਬਨ ਸਾਡੇ ਘਰ ਤੋਂ ਹੈਗਾ ਕਿ ਆਪਣਾ ਅੱਠ ਦਸ ਕਿਲੋਮੀਟਰ ਹੈਗਾ ਅਤੇ ਗੱਡੀ 'ਤੇ ਜਾਂ ਬਾਈਕ 'ਤੇ ਕਿਤਨਾ ਉਹ ਜਾਂਦੇ ਰਹਿੰਦੇ ਹਾਂ ਅਤੇ ਮੈਨੂੰ ਬਹੁਤ ਹੀ ਸਕੂਨ ਮਿਲਦਾ ਹੈ ਉੱਥੇ ਜਾ ਕੇ